ਪੰਜਾਬ ਦੇ ਵਿੱਚ ਹਰੇਕ ਖਿੱਤੇ ਦਾ ਆਪਣਾ ਆਪਣਾ ਪਹਿਰਾਵਾ ਹੈ ਜਿਹਦੇ ਵਿੱਚ ਹਰੇਕ ਕੋਈ ਆਪਣਾ ਪਹਿਰਾਵਾ ਪਾਉਂਦਾ ਹੈਗਾ ਜਿਵੇਂ ਕਿ ਹਿੰਦੂ ਸਮਾਜ ਦੇ ਲੋਕ ਸਾੜੀ ਲਾਉਂਦੇ ਹਨ ਅਤੇ ਪੰਜਾਬ ਦੇ ਪੰਜਾਬੀ ਔਰਤਾਂ ਜਿਹੜੀਆਂ ਹੁੰਦੀਆਂ ਨੇ ਉਹ ਜ਼ਿਆਦਾਤਰ ਪੰਜਾਬੀ ਸੂਟ ਪਾਉਂਦੀਆਂ ਨੇ ਪੰਜਾਬੀ ਸੂਟਾਂ ਦੇ ਵਿੱਚ ਵੀ ਬਹੁਤ ਤਰ੍ਹਾਂ ਦੀ ਵਰਾਈਟੀ ਆਉਂਦੀ ਹੈ ਜਿਵੇਂ ਕਿ ਪਲਾਜੋ ਪਾ ਪਲਾਜੋ ਸੂਟ ਹੋਇਆ ਫਰਾਕ ਸੂਟ ਹੋਇਆ ਫੁਲਕਾਰੀ ਹੋਈ ਲਹਿੰਗਾ ਹੋਇਆ ਅਤੇ ਘੱਗਰਾ ਸੂਟ ਹੋਇਆ ਇਹ ਸਾਰੇ ਪੰਜਾਬੀ ਸੂਟ ਵਧੀਆ ਅਤੇ ਕੋਈ ਸ਼ੋਟ 'ਚ ਪਾਉਂਦਾ ਕੋਈ ਲੌਂਗ 'ਚ ਪਾਉਂਦਾ ਕੋਈ ਹਾਫ ਬਾਜੂ ਕੋਈ ਫੁੱਲ ਬਾਜੂ ਕੋਈ ਕੁੜਤੀ ਪਾਉਂਦਾ ਹੈ ਕੋਈ ਕੀ ਕਿ ਪਿੱਛੇ ਬਟਨ ਆ ਕੋਈ ਕਿਵੇਂ ਅੱਗੇ ਕੋਈ ਸਾਰਾ ਮਤਲਬ ਸਭ ਦੀ ਆਪਣੀ ਆਪਣੀ ਚੋਇਸ ਆ ਇਹ ਸਾਰਾ ਸਾਡੇ ਆਪਣੇ ਸੱਭਿਆਚਾਰ ਦਾ ਇੱਕ ਮ ਅਨਿੱਖੜਵਾਂ ਅੰਗ ਨੇ ਅਤੇ ਵਿਆਹਾਂ ਦੇ ਵਿੱਚ ਵੀ ਲੇਡੀ ਤੋਂ ਬਿਨਾਂ ਅਤੇ ਸਭ ਤੋਂ ਵੱਧ ਕੱਪੜਾ ਜਿਹੜਾ ਪਾਉਂਦੇ ਜਨਾਨੀਆਂ ਪਾਉਂਦੀਆਂ ਨੇ ਕਿਉਂਕਿ ਮਹਿੰਗਾ ਵੀ ਕੱਪੜਾ ਇਹਨਾਂ ਦਾ ਹੀ ਆ